ਪੇਂਟ ਕਰਨ ਦੇ ਟਾਈਮ 'ਤੇ ਮੇਰਾ ਮਨਪਸੰਦ ਵਿਸ਼ੇ ਹੁੰਦਾ ਹੈ ਨੇਚਰ ਪ੍ਰਕਿਰਤੀ ਮੈਂ ਜਦੋਂ ਵੀ ਪੇਂਟਿੰਗ ਕਰਨਾ ਚਾਹਦੀ ਹਾਂ ਨਾ ਮੈਂ ਬਸ ਜਿੰਨਾ ਹੋ ਸਕੇ ਨੇਚਰ ਨੂੰ ਪ੍ਰਕਿਰਤੀ ਨੂੰ ਆਪਣੇ ਕਲਰ ਰੰਗਾਂ ਰਾਹੀਂ ਨਾ ਆਪਣੇ ਕੈਨਵਸ 'ਤੇ ਉਤਾਰ ਲੈਂਦੀ ਹਾਂ ਮੈਨੂੰ ਬਹੁਤ ਵਧੀਆ ਤਰੀਕਾ ਲੱਗਦਾ ਹੈ ਕਿ ਮੈਂ ਰੰਗਾਂ ਰਾਹੀਂ ਉਸ ਪ੍ਰਕਿਰਤੀ ਨੂੰ ਆਪਣੇ ਨੇੜੇ ਮਹਿਸੂਸ ਕਰਦੀ ਹਾਂ ਬਹੁਤ ਜ਼ਿਆਦਾ ਹੀ ਅੱਜ ਕੱਲ੍ਹ ਪ੍ਰਕਿਰਤੀ ਜਿਹੜੀ ਹੈ ਉਹ ਦੇਖਣ ਨੂੰ ਬਹੁਤ ਹੀ ਘੱਟ ਮਿਲਦੀ ਹੈ ਮਗਰ ਜੇ ਆਪਾਂ ਪਿਚਰਸ ਵਿੱਚ ਰੰਗਾਂ ਰਾਹੀਂ ਦੇਖੀਏ ਬਹੁਤ ਵਧੀਆ ਅਤੇ ਕਿੰਨੀ ਸ਼ਾਂਤੀ ਅੱਖਾਂ ਨੂੰ ਵੀ ਸਕੂਨ ਮਿਲਦਾ ਹੈ ਅਤੇ ਮਨ ਖੁਸ਼ ਹੋ ਜਾਂਦਾ ਹੈ